ਸਾਡੇ ਖੇਤਰ ਦੀ ਪੁਲਿਸ ਪਠਾਨਕੋਟ ਪੁਲਿਸ ਦੁਰਘਟਨਾਵਾਂ ਅਤੇ ਅਪਰਾਧ ਨੂੰ ਕੰਟਰੋਲ ਕਰਨ ਵਿੱਚ ਕਾਫੀ ਵਧੀਆ ਰਹੇ ਆ ਅਤੇ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਇਕੱਲੇ ਇਕੱਲੇ ਪਠਾਨਕੋਟ ਪੁਲਿਸ ਹੀ ਨਹੀਂ ਬਾਕੀ ਵੀ ਜਗ੍ਹਾ ਜਿੱਥੇ ਜਿੱਥੇ ਪੰਜਾਬ ਪੁਲਿਸ ਹੈਗੀ ਆ ਅਤੇ ਉੱਥੇ ਕਾਫੀ ਵਧੀਆ ਢੰਗ ਨਾਲ ਦੁਰਘਟਨਾਵਾਂ ਅਤੇ ਅਪਰਾਧ ਨੂੰ ਰੋਕਿਆ ਜਾ ਰਿਹਾ ਅਤੇ ਹਾਲ ਹੀ ਵਿੱਚ ਆਈਆਂ ਪੰਜਾਬ ਸਰਕਾਰ ਦੀਆਂ ਸਕੀਮਾਂ ਅਤੇ ਜਿਹੜੀਆਂ ਕਿ ਲਾਗੂ ਹੋਈਆਂ ਨੇ ਅਤੇ ਮੈਨੂੰ ਲੱਗਦਾ ਕਿ ਕਾਫੀ ਵਧੀਆ ਅਤੇ ਮੂਲ ਢੰਗ ਨਾਲ ਇਸ ਚੀਜ਼ ਨੂੰ ਦੇਖਿਆ ਜਾ ਰਿਹਾ ਅਤੇ ਨਸ਼ਿਆਂ ਜਿਸ ਜਿਸਦੇ ਕਾਰਨ ਨਸ਼ਿਆਂ ਅਤੇ ਕਾਫੀ ਲੁੱਟਮਾਰ ਲੜਾਈ ਝਗੜਿਆਂ ਦੇ ਮਾਮਲਿਆਂ 'ਚ ਵੀ ਕਾਫੀ ਸਖਤੀ ਅਤੇ ਸਖਤੀ ਵਰਤੀ ਜਾ ਰਹੀ ਆ ਗੱਲ ਕੀਤੀ ਜਾਵੇ ਕਿ ਨਾਗਰਿਕਾਂ ਦੀ ਜਦੋਂ ਸੁਰੱਖਿਆ ਦੀ ਗੱਲ ਆਉਂਦੀ ਹੈ ਅਤੇ ਹਰ ਜਗ੍ਹਾ 'ਤੇ ਪੁਲਿਸ ਫੋਰਸ ਤੈਨਾਤ ਕੀਤੀ ਜਾਂਦੀ ਹੈ ਅਤੇ ਕਈ ਨੰਬਰ ਵੀ ਮਤਲਬ ਇੱਦਾਂ ਦੇ ਪੁਲਿਸ ਫੋਰਸ ਦੇ ਅੱਗੇ ਜਿਹਨਾਂ ਕਰ ਜਿਹਨਾਂ ਨਾਲ ਤੁਸੀਂ ਮਤਲਬ ਕਾਫੀ ਘੱਟ ਟਾਈਮ ਵਿੱਚ ਹੀ ਪੁਲਿਸ ਨੂੰ ਆਪਣੇ ਘਰ ਬੁਲਾ ਸਕਦੇ ਹੋ ਅਤੇ ਆਪਣੀ ਜਾਣਕਾਰੀ ਦੇ ਸਕਦੇ ਹੋ ਜੋ ਵੀ ਤੁਹਾਡੇ ਨਾਲ ਹੋਇਆ ਹੈੈ